ਹਾਂਜੀ ਓਨਲਾਈਨ ਬੈਂਕਿੰਗ ਕਰਦੇ ਸਮੇਂ ਆਪਣੀ ਨਿੱਜੀ ਅਤੇ ਵਿੱਤੀ ਜਾਣਕਾਰੀ ਦੀ ਸੁਰੱਖਿਆ ਲਈ ਅਸੀਂ ਕਈ ਮੈਂ ਕਈ ਤਰ੍ਹਾਂ ਦੇ ਉਪਰਾਲੇ ਕਰਦੀ ਹਾਂ ਜਿੱਦਾਂ ਮਤਲਬ ਕਿ ਅਸੀਂ ਮੈਂ ਆਪਣੇ ਜਿਸ ਐਪ ਦੇ ਉੱਤੇ ਮੈਂ ਓਨਲਾਈਨ ਬੈਂਕਿੰਗ ਕਰਦੀ ਹਾਂ ਉਹਦਾ ਮੈਂ ਸਟਰੋਂਗ ਪਾਸਵਰਡ ਲਗਾ ਕੇ ਰੱਖਦੀ ਹਾਂ ਯੂ ਪੀ ਆਈ ਪਿੰਨ ਵਗੈਰਾ ਮੈਂ ਆਪਣਾ ਪੂਰਾ ਸਿਕਿਓਰ ਰੱਖਦੀ ਹਾਂ ਕਿਸੇ ਨਾਲ ਸ਼ੇਅਰ ਨਹੀਂ ਕਰਦੀ ਆਪਣਾ ਪਾਸਵਰਡ ਨੂੰ ਮੈਂ ਪ੍ਰੋਪਰ ਸਿਕਿਓਰ ਰੱਖਦੀ ਹਾਂ ਤਾਂ ਜੋ ਉਹਨੂੰ ਕੋਈ ਖੋਲ੍ਹ ਨਾ ਸਕੇ ਨਾ ਹੀ ਮੈਂ ਆਪਣਾ ਫੋਨ ਕਿਸੇ ਨੂੰ ਦਿੰਦੀ ਹਾਂ ਤਾਂ ਜੋ ਕੋਈ ਵਰਤ ਨਾ ਸਕੇ ਅਤੇ ਆਪਣੇ ਸੁਭਾਵੀ ਖਤਰਿਆਂ ਜਾਂ ਸਾਈਬਰ ਹਮਲਿਆਂ ਤੋਂ ਬਚਣ ਦੇ ਲਈ ਮੈਂ ਆਪਣਾ ਆਧਾਰ ਕਾਰਡ ਕਿਸੇ ਨੂੰ ਸ਼ੇਅਰ ਨਹੀਂ ਕਰਦੀ ਹਾਂ ਆਪਣਾ ਬੈਂਕ ਖਾਤਾ ਕਿਸੇ ਨਾਲ ਸ਼ੇਅਰ ਨਹੀਂ ਕਰਦੀ ਅਤੇ ਨਾ ਹੀ ਮੈਂ ਕੋਈ ਇਸ ਤਰ੍ਹਾਂ ਦੀ ਐਪ ਨੂੰ ਸ਼ੇਅਰ ਕਰਦੀ ਹਾਂ ਜਿਹਦੇ ਤੋਂ ਮਤਲਬ ਕਿ ਸਾਨੂੰ ਕੋਈ ਖਤਰਾ ਹੋਵੇ ਨਾ ਹੀ ਮੈਂ ਕੋਈ ਕਾਲ ਇੱਦਾਂ ਦੀ ਅਟੈਂਡ ਕਰਦੀ ਹਾਂ ਜਾਂ ਫਿਰ ਕੋਈ ਮੈਸੇਜ ਵਗੈਰਾ ਜਾਂ ਕੋਈ ਵੀ ਇੱਦਾਂ ਦਾ

ਖਤਰਾ ਹੋਵੇ ਧੰਨਵਾਦ